ਹੈਲੋ ਹਾਂਜੀ ਬੋਲੋ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਥੇ ਹੈਗਾ ਜੀ ਹੋਮ ਸੈਡ ਹੋਟਲ ਹੈਗਾ ਜੀ ਅਬੋਹਰ ਰੋਡ 'ਤੇ ਬਹੁਤ ਵਧੀਆ ਜੀ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਹੈਗਾ ਕਮਰੇ ਸਾਫ਼ ਸੁਥਰੇ ਨੇ ਬਹੁਤ ਵਧੀਆ ਹੈਗਾ ਜੀ ਨਾਲ ਪੈਰਾਡਾਈਜ ਜੋ ਹੈਗਾ ਜੀ ਹਵੇਲੀ ਹੈਗੀ ਹੈ ਖਾਣ ਪੀਣ ਦਾ ਬਹੁਤ ਅੱਛਾ ਪ੍ਰਬੰਧ ਹੈਗਾ ਜੀ ਵੈਜ ਹੈਗਾ ਜੀ ਤਿੰਨ ਚਾਰ ਰੋਡ ਹੈਗੇ ਆ ਜੀ ਜਿਵੇਂ ਪੈਰਾਡਾਈਜ ਹੋ ਗਿਆ ਜੀ ਹਵੇਲੀ ਫੂਡ ਟਨਲ ਹੋ ਗਿਆ ਜੀ ਪੇੜਿਆਂ ਦਾ ਹੋ ਗਿਆ ਜੀ ਇਹ ਸਾਰੇ ਬੈਸਟ ਨੇ ਜੀ ਸਭ ਤੋਂ ਵਧੀਆ ਤੁਹਾਨੂੰ ਫੂਡ ਟਨਲ ਮਿਲੇਗਾ ਹੋਮ ਸੈਡ ਮਿਲੇਗਾ ਜੀ ਇਥੇ ਖਾਣ ਪੀਣ ਤੁਹਾਨੂੰ ਵਧੀਆ ਮਿਲੇਗਾ ਤੁਸੀਂ ਉੱਥੇ ਵਧੀਆ ਰਾਤ ਰੁਕ ਸਕਦੇ ਹੋ ਅਤੇ ਦੋ ਚਾਰ ਦਿਨ ਓਥੇ ਲਗਾ ਕੇ ਹਾਂਜੀ ਹਾਂਜੀ ਬਹੁਤ ਅੱਛਾ ਜੀ ਰਹਿਣ ਨੂੰ ਸਾਫ਼ ਸਫ਼ਾਈ ਦਾ ਪ੍ਰਬੰਧ ਪੂਰਾ ਕਰਦੀ ਪੂਰੀ ਹੈ ਵੈਲ ਮਾਰੋਗੇ ਪਾਣੀ ਆ ਜਾਏਗਾ ਹਾਂਜੀ ਜੀ ਅੱਠ ਸੌ ਤੋਂ ਲੈ ਕੇ ਬਾਰਾਂ ਸੌ ਰੁਪਈਆ ਹੈਗਾ ਜੀ ਅਲੱਗ ਅਲੱਗ ਰੂਮ ਦਾ ਅਲੱਗ ਅਲੱਗ ਰੇਟ ਹੈਗਾ ਜੀ ਹਾਂਜੀ ਘੁੰਮਣ ਨੂੰ ਵੀ ਨੇੜੇ ਬਹੁਤ ਵਧੀਆ ਅੱਛੀ ਅੱਛੀ ਆਸੇ ਪਾਸੇ ਜਗ੍ਹਾ ਹੈਗੀਆਂ ਨੇ ਜਿਵੇਂ ਉੱਥੇ ਘੰਟਾ ਘਰ ਹੈਗਾ ਜੀ ਵੇਖਣ ਵਾਲਾ ਵੱਡਾ ਹਾਂਜੀ ਇੱਥੇ ਜੀ ਇੱਥੇ ਜੀ ਆਪਣੇ ਇੱਕ ਛੋਟਾ ਇੱਕ ਛੋਟਾ ਕਿਲਾ ਹੋ ਗਿਆ ਪੁਰਾਣੇ ਰਾਜੇ ਦਾ ਉਹ ਵੇਖ ਲਿਆ ਜੀ ਠੀਕ ਹੈ ਜੀ ਮੰਦਰ ਬਹੁਤ ਅੱਛੇ ਹੈਗੇ ਆ ਕਾਲੀ ਮਾਤਾ ਦਾ ਮੰਦਰ ਹੈਗੇ ਦੁਰਗਾ ਮਾਤਾ ਦਾ ਮੰਦਰ ਹੈਗਾ ਜੀ ਲਛਮੀ ਨਰਾਇਣ ਦਾ ਮੰਦਰ ਹੈਗਾ ਜੀ ਦੇਖਣ ਨੂੰ ਹਿਸਟੋਰੀਕਲ ਪਲੇਸ ਐਂਡ ਉੱਥੇ ਹਾਂਜੀ ਹਾਂਜੀ ਤੁਸੀਂ ਬੋਡਰ 'ਤੇ ਜਾ ਕੇ ਸ਼ਾਮ ਨੂੰ ਪਰੇਡ ਹੁੰਦੀ ਹੈ ਇੰਡੀਆ ਪਾਕਿਸਤਾਨ ਦਾ ਮੇਨ ਬੋਡਰ ਹੈ ਜੀ ਐਥੋਂ ਅੱਠ ਦਸ ਕਿਲੋਮੀਟਰ ਅੱਗੇ ਉੱਥੇ ਤੁਸੀਂ ਇਥੋਂ ਨਿਕਲ ਜਾਓ ਸਾਢੇ ਤਿੰਨ ਵਜੇ ਨਿਕਲ ਜਾਓ ਤੁਸੀਂ ਉੱਥੇ ਚਾਰ ਸਵਾ ਚਾਰ ਪਹੁੰਚ ਜਾਓਗੇ ਅੱਧਾ ਪੌਣਾ ਘੰਟਾ ਤੁਸੀਂ ਉੱਥੇ ਪਹਿਲੇ ਘੁੰਮੋ ਬਾਰਡਰ ਦੇਖੋ ਉਸ ਤੋਂ ਬਾਅਦ ਸਾਡੇ ਪੰਜ ਵਜੇ ਸਰਦੀਆਂ ਦੇ ਦਿਨ ਨੇ ਜੀ ਸਾਡੇ ਪੰਜ ਵਜੇ ਪਰੇਡ ਸ਼ੁਰੂ ਹੋ ਜਾਵੇਗੀ ਪਰੇਡ ਸ਼ੁਰੂ ਹੋਣ ਤੋਂ ਬਾਅਦ ਤਾਂ ਤੁਸੀਂ ਉੱਥੇ ਪਰੇਡ ਦੇਖੋ ਅੱਧਾ ਪੌਣਾ ਘੰਟਾ ਜਾਣ ਦੇ ਸਾਧਨ ਉੱਥੇ ਜੇ ਤੁਹਾਡੇ ਕੋਲ ਆਪਦਾ ਵੀਕਲ ਨਹੀਂ ਹੈਗਾ ਤੁਹਾਨੂੰ ਇੱਥੋਂ ਕੈਬ ਮਿਲ ਜਾਏਗੀ ਕੈਬ ਤੁਸੀਂ ਫੋਨ ਕਰੋਗੇ ਤੁਹਾਡਾ ਨੰਬਰ ਪ੍ਰੋਵਾਈਡ ਕਰਾਇਆ ਜਾਏਗਾ ਉੱਥੇ ਰੈਸਟੋਰੈਂਟ ਹੈਗਾ ਉੱਥੇ ਤੁਸੀਂ ਖਾਣਾ ਵੀ ਖਾ ਸਕਦੇ ਹੋ ਸ਼ਾਮ ਨੂੰ ਹਾਂਜੀ ਇਹ ਪਹਿਲੇ ਦਿਨ ਦਾ ਇਹ ਚੀਜ਼ ਬਣਾ ਲਓ ਇਸ ਤੋਂ ਇਲਾਵਾ ਵੀ ਹਾਂਜੀ ਕਿਲਾ ਆ ਜੀ ਪੁਰਾਣੇ ਰਾਜੇ ਦਾ ਇੱਥੇ ਬਹੁਤ ਵੱਡਾ ਕਿਲਾ ਹੈਗਾ ਕਿਲਾ ਵੇਖੋ ਉੱਥੇ ਕਿਲਾ ਘੁੰਮੋ ਘੱਟੋ ਘੱਟ ਤਿੰਨ ਚਾਰ ਦਿਨ ਚਾਹੀਦੇ ਤਿੰਨ ਚਾਰ ਘੰਟੇ ਚਾਹੀਦੇ ਘੁੰਮਣ ਤੇ ਹਾਂਜੀ ਹਾਂਜੀ ਨਾਲ ਘੁੰਮੋ ਆਪਦਾ ਵਧੀਆ ਜੀ ਉੱਤੇ ਆਪਣੀ ਹਾਂਜੀ ਇਹ ਤੁਹਾਨੂੰ ਗਾਈਡ ਗਾਈਡ ਚਾਹੀਦਾ ਅਤੇ ਆਪਣੇ ਉਥੇ ਫਾਜ਼ਿਲਕਾ ਸਾਡੇ ਗਾਈਡ ਹੈਗੇ ਉਹ ਤੁਹਾਨੂੰ ਲੈ ਜਾਣਗੇ ਗਾਈਡ ਕਰ ਦੇਣਗੇ ਨਾਲ ਹਾਂਜੀ ਪੰਜ ਸੌ ਰੁਪਈਆ ਉਹਨਾਂ ਨੇ ਲੈਣਾ ਜੀ ਇੱਕ ਇੱਕ ਜਣਾ ਹੁੰਦਾ ਜਿਹੜਾ ਵੀ ਗਾਈਡ ਤੁਹਾਨੂੰ ਚਾਹੀਦਾ ਇੱਕ ਦਿਨ ਦਾ ਗਾਈਡ ਕਰ ਦਿੰਦੇ ਨਾਲ ਹਾਂਜੀ ਹਾਂਜੀ ਹਾਂਜੀ ਇਸੇ ਨੰਬਰ 'ਤੇ ਫੋਨ ਕਰਦੇ ਆ ਜੇ ਹਾਂਜੀ ਕੋਈ ਗੱਲ ਨਹੀਂ ਹੋਟਲ ਵੀ ਅਰੇਂਜਮੈਂਟ ਹੋ ਜਾਏਗਾ ਜੀ ਜਾਣ ਆਉਣ ਦਾ ਸਾਧਨ ਵੀ ਹੋ ਜਾਏਗਾ ਜੀ ਖਾਣ ਪੀਣ ਦਾ ਪ੍ਰਬੰਧ ਵੀ ਕਰ ਦੇਵਾਂਗੇ ਜੀ ਜਗਾ ਵੀ ਘੁੰਮਾ ਦੇਵਾਂਗੇ ਜੀ ਵਾਪਸੀ ਟਿਕਟਾਂ ਵੀ ਬੁੱਕ ਕਰਾ ਦਿੰਦੇ ਜੀ ਓਕੇ ਜੀ ਥੈਂਕ ਯੂ ਜੀ ਥੈਂਕ ਯੁ ਸੋ ਮਚ ਜੀ